ਚੌਵੀ ਇੱਕ ਸੌ ਇਕੱਤੀ ਪੰਦਰਾਂ ਸੌ ਪੱਚੀ ਸੌ ਪੱਚੀ ਹਜ਼ਾਰ ਨੌਂ ਸੌ ਉਣਹੱਤਰ ਦੋ ਲੱਖ ਸੱਠ ਹਜ਼ਾਰ ਛੇ ਸੌ ਉਣਹੱਤਰ